ਵੱਖ ਵੱਖ ਤਰਾਂ ਦੇ ਪਕਵਾਨ ਬਣਾਏ ਜਾਂਦੇ ਹਨ ਜਿਹਦੇ ਵਿੱਚ ਕੱਦੂ ਬੂਰੀ ਪੂਰੀਆਂ ਛੋਲੇ ਆਲੂ ਦੇ ਪਰਾਂਠੇ ਗੋਭੀ ਦੇ ਪਰਾਂਠੇ ਘੀਆ ਦੇ ਪਰਾਂਠੇ ਗੁਲਗਲੇ ਕਚੌਰੀਆਂ ਕਈ ਤਰ੍ਹਾਂ ਦੇ ਪਕੌੜੇ ਬਣਾਏ ਜਾਂਦੇ ਹਨ ਅਤੇ ਖੀਰ ਪੂੜੇ ਵੀ ਬਣਾਏ ਜਾਂਦੇ ਹਨ ਜ਼ਿਆਦਾਤਰ ਮੈਨੂੰ ਸੌਖੇ ਖੀਰ ਪੂੜੇ ਬਣਾਉਣੇ ਲੱਗਦੇ ਹਨ